ਖੇਡਾਂ ਹਰ ਇੱਕ ਵਿਅਕਤੀ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਸਾਡੇ ਸਮਾਜ ਵਿੱਚ ਖੋ ਖੋ ਕੋਟਲਾ ਛਪਾਕੀ ਲੁਕਣ ਮੀਚੀ ਕਬੱਡੀ ਕੁਸ਼ਤੀ ਬੈਡਮਿੰਟਨ ਹੈਂਡਬਾਲ ਡਸਬਾਲ ਫੁਟਬਾਲ ਆਦਿ ਖੇਡਾਂ ਖੇਡੀਆਂ ਜਾਂਦੀਆਂ ਹਨ ਖੇਡਾਂ ਖੇਡਣ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ ਇਸ ਨਾਲ ਜਦੋਂ ਅਸੀਂ ਖੇਡਦੇ ਹਾਂ ਤਾਂ ਸਾਨੂੰ ਪਸੀਨਾ ਆਉਂਦਾ ਉਸ ਨਾਲ ਸਾਡੇ ਸਰੀਰ ਅੰਦਰੋਂ ਬਿਮਾਰੀਆਂ ਬਾਹਰ ਨਿਕਲਦੀਆਂ ਹਨ ਹਰ ਇੱਕ ਵਿਅਕਤੀ ਨੂੰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਜਿਵੇਂ ਸਾਡਾ ਪੰਜਾਬ ਅੱਜ ਕੱਲ੍ਹ ਨਸ਼ਿਆਂ ਵੱਲ ਜਾ ਰਿਹਾ ਹੈ ਤਾਂ ਉਸ ਨੂੰ ਮੋੜਨ ਲਿਆ ਇੱਕੋ ਇੱਕ ਰਸਤਾ ਹੈ ਇਹ ਖੇਡਾਂ ਇਸ ਲਈ ਹਰ ਇੱਕ ਵਿਅਕਤੀ ਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਸਾ ਹਰ ਇਕ ਜਿਵੇਂ ਕੋਈ ਸਟੂਡੈਂਟ ਹੁੰਦਾ ਹੈ ਉਹ ਆਪਣੀ ਗੇਮ ਰੱਖਦਾ ਹੈ ਅਤੇ ਆਪਣੀ ਪੜ੍ਹਾਈ ਨਾ ਪੜ੍ਹਾਈ ਰਾ ਪੜ੍ਹਾਈ ਨਾਲ ਚੱਲਦਾ ਹੈ ਹਰ ਇੱਕ ਹਰ ਇੱਕ ਵਿਅਕਤੀ ਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਸਾਡੇ ਧੰ ਧੰ ਪਿੰਡਾਂ ਵਿੱਚ ਜਿਵੇਂ ਹਰ ਸਾਲ ਖੇਡਾਂ ਕਰਵਾਈਆਂ ਜਾਂਦੀਆਂ ਹਨ